ਤਕਨੋਲਜੀ ਦੇ ਖੇਤਰ ਵਿੱਚ ਸਮਾਜ ਅੰਦਰ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਤਕਨੋਲਜੀ ਦੇ ਅਨੁਸਾਰ ਜਿਹੜੀ ਆਪਣਾ ਰੇਡੂਆ ਟੈਲੀਵਿਜ਼ਨ ਫੋਨ ਇਹ ਅੱਛਾ ਇਹਨਾਂ ਟੈਕਨੋਲਜੀਆਂ ਨੇ ਹੀ ਸੰਸਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਈ ਪਾਇਆ ਹੈ ਤਾਂ ਜੋ ਸਾਨੂੰ ਸੰਸਾਰ ਅੰਦਰ ਵਾਪਰਨੀਆਂ ਕਈ ਘਟਨਾਵਾਂ ਕਿਤੇ ਵੀ ਕੋਈ ਗੱਲਬਾਤ ਉਹ ਅਸੀਂ ਆਪਣੇ ਫੋਨ ਜ਼ਰੀਏ ਸ਼ੋਸ਼ਲ ਮੀਡੀਆ ਮਕੀ ਆਪਣੇ ਜਿਵੇਂ ਵੀ ਜ਼ਰੀਏ ਜਾਣੀ ਕਿ ਸੁਣਦੇ ਹਾਂ ਉਹ ਚੀਜ਼ ਸਾਡੇ ਲਈ ਬਹੁਤ ਹੀ ਇੱਕ ਵੱਡੀ ਭੂਮਿਕਾ ਨਿਭਾਉਂਦੀ ਹੈ